ਸਾਡੇ ਖੇਤਰ ਵਿੱਚ ਰਵਾਇਤੀ ਖੇਡਾਂ ਬਹੁਤ ਹਨ ਜਿਸ ਵਿੱਚ ਖੇ ਜਿਸ ਵਿੱਚ ਹਾਕੀ ਕਬੱਡੀ ਗੁੱਲੀ ਡੰਡਾ ਚਿੜੀ ਛਿਕਾ ਫੁੱਟਬਾਲ ਖੇਡਾਂ ਖੇਡੀਆਂ ਜਾਂਦੀਆਂ ਹਨ ਮੈਨੂੰ ਵੀ ਇਸ ਖੇਡ ਦਾ ਬਹੁਤ ਜ਼ਿਆਦਾ ਖੇਡਣ ਵਿੱਚ ਮ ਮਜ਼ਾ ਆਉਂਦਾ ਹੈ ਇਸ ਲਈ ਜਦੋਂ ਮੈਂ ਫਰੀ ਹੋਵਾਂ ਤਾਂ ਮੈਂ ਇਹ ਖੇਡਾਂ ਖੇਡਣ ਜ਼ਰੂਰ ਜਾਂਦਾਂ ਹਾਂ ਘਰ ਬੈਠ ਕੇ ਜੋ ਫਿਰ ਫਰੀ ਤਾਂ ਹੀ ਉਹ ਜਦੋਂ ਹੁੰਦਾ ਹਾਂ ਅਤੇ ਖੇਡਾਂ ਦਾ ਬਹੁਤ ਰਵਾਇਤੀ ਮਤਲਬ ਹੁੰਦਾ ਹੈ ਇਸ ਲਈ ਇਹ ਖੇਡਾਂ ਖੇਡੀਆਂ ਜ ਜਾਣੀਆਂ ਚਾਹੀਦੀਆਂ ਹਨ ਸੈ ਜਦੋਂ ਮੈਂ ਘਰ ਬੈਠਾ ਵਿਹਲਾ ਹੁੰਦਾ ਹਾਂ ਅਤੇ ਸੋਚਦਾ ਹਾਂ ਕਿ ਦਿਮਾਗ ਕਿੱਧਰ ਜਾਂਦਾ ਕਿੱਧਰ ਨਹੀਂ ਇਸ ਲਈ ਮੈਂ ਖੇਡਾਂ ਵਿੱਚ ਗਲੀ ਵਿੱਚ ਵੀ ਕ੍ਰਿਕਟ ਖੇਡ ਲੈਂਦਾ ਹਾਂ ਆਪਣੀਆਂ ਖੇਡਾਂ ਨੂੰ ਮੈਂ ਭੁੱਲਿਆ ਨਹੀਂ ਇਸ ਲਈ ਖੇਡਾਂ ਖੇਡਣੀਆਂ ਸਭ ਨੂੰ ਚ ਰਿਵਾਇਤੀ ਆਪਣੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਭੁੱਲਣੀਆਂ ਨਹੀਂ ਚਾਹੀਦੀਆਂ